ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਆਰਤੀ ਹੈ ਸਰ ਮੈਂ ਪਠਾਨਕੋਟ ਤੋਂ ਬੋਲਦੀ ਪਈ ਐਂ ਸਰ ਮੈਂ ਕੁਝ ਦਿਨ ਪਹਿਲਾਂ ਤੁਹਾਡੇ ਤੋਂ ਇੱਕ ਪੱਖਾ ਓਡਰ ਕੀਤਾ ਸੀ ਕਿਉਂਕਿ ਮੇਰੇ ਘਰ ਵਿੱਚ ਦੁਕਾਨ ਹੈ ਦੁਕਾਨ ਵਿੱਚ ਪੱਖਾ ਲਗਾਉਣਾ ਚਾਹੁੰਦੀ ਸੀ ਤਾਂ ਤੁਸੀਂ ਤਾਂ ਬਾਰਾਂ ਦਿਨ ਦਾ ਓਡਰ ਦਿੱਤਾ ਸੀ ਅਤੇ ਪੱਖਾ ਦੋ ਦਿਨ ਲੇਟ ਆਇਆ ਉਹ ਤਾਂ ਸਰ ਕੋਈ ਗੱਲ ਨਹੀਂ ਜਿਸ ਟਾਇਮ ਪੱਖਾ ਘਰ ਆਇਆ ਤਾਂ ਮੈਂ ਇਲੈਕਟ੍ਰੀਸ਼ਨ ਵਾਲੇ ਨੂੰ ਬੁਲਾਇਆ ਇਲੈਕਟ੍ਰੀਸ਼ਨ ਵਾਲੇ ਨੇ ਸਭ ਕੁਛ ਲਗਾ ਲਗੂ ਦਿੱਤਾ ਜਿਸ ਟਾਇਮ ਪੱਖਾ ਚਲਾਉਣ ਲੱਗੇ ਤਾਂ ਪੱਖੇ ਦੀ ਮੋਟਰ ਸੜੀ ਹੋਈ ਸੀ ਤਾਂ ਕਿ ਇਲੈਕਟ੍ਰੀਸ਼ਨ ਵਾਲਿਆਂ ਨੇ ਵੀ ਕਹਿ ਦਿੱਤਾ ਕਿ ਪੱਖਾ ਖਰਾਬ ਹੈ ਇਲੈਕਟ੍ਰੀਸ਼ਨ ਵਾਲਿਆਂ ਨੇ ਕਿਹਾ ਕਿ ਮੋਟਰ ਸੜੀ ਹੋਈ ਹੈ ਇਸਦੀ ਇਸਨੂੰ ਵਾਪਸ ਕੀਤਾ ਜਾਏ ਜਾਂ ਮੇਰੇ ਪੈਸੇ ਵਾਪਸ ਕੀਤੇ ਜਾਣ